ਹੈਲੋ ਸੋਨੂੰ ਪੇਂਟਰ ਬੋਲ ਰਹੇ ਹੋ ਹਾਂਜੀ ਵੀਰ ਸਾਡਾ ਮਕਾਨ ਸਾਡਾ ਮਕਾਨ ਹੈ ਹੂੰ ਪੱਚੀ ਬਾਈ ਪੱਚੀ ਦਾ ਦੋ ਫਲੋਰ ਉਹਨੂੰ ਪੇਂਟ ਕਰਵਾਉਣਾ ਹੈ ਮੈਂ ਨਹੀਂ ਨਹੀਂ ਹਾਂਜੀ ਹਾਂਜੀ ਤਾਂ ਤੁਸੀਂ ਉਹ ਸਾਰਾ ਕੁਝ ਸਿਸਟਮ ਤੁਹਾਡੇ ਹੱਥ 'ਤੇ ਹੈ ਤੁਸੀਂ ਦੱਸੋ ਸਾਰਾ ਪ੍ਰੋਸੀਜ਼ਰ ਕੀ ਹੈ ਕਿਵੇਂ ਹੈ ਠੀਕ ਹੈ ਠੀਕ ਹੈ

ਤੁਸੀਂ ਵਿਜ਼ਿਟ ਕਦੋਂ ਕਰੋਗੇ ਅੱਛਾ ਚਲੋ ਜੀ ਤੁਸੀਂ ਸਾਈਟ ਵਿਜਿਟ ਕਰ ਲਿਆ ਜੇ ਬਾਕੀ ਗੱਲ ਆਪਾਂ ਉੱਦੋਂ ਕਰ ਲਾਂਗੇ